ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਦਾ ਸਮਾਜ ਦੇ ਵਿਕਾਸ ਵਿੱਚ ਬੜਾ ਰੋਲ ਹੁੰਦਾ ਹੈ ਅਤੇ ਪੇਂਡੂ ਖੇਤਰ ਵਿੱਚ ਤਾਂ ਖੇਡਾਂ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਕਿਉਂਕਿ ਪਿੰਡਾਂ ਵਾਲੇ ਲੋਕ ਆਪਣਾ ਟਾਈਮ ਬਤੀਤ ਕਰਨ ਲਈ ਇਹਨਾਂ ਖੇਡਾਂ ਦਾ ਸਹਾਰਾ ਹੀ ਲੈਂਦੇ ਹਨ ਖੇਡਾਂ ਦਾ ਬੱਚਿਆਂ ਦੇ ਜੀਵਨ ਵਿੱਚ ਵੀ ਬਹੁਤ ਬੜਾ ਮਹੱਤਵ ਹੁੰਦਾ ਹੈ ਖੇਡਾਂ ਬੱਚਿਆਂ ਦੇ ਜੀਵਨ ਦਾ ਸਰੀਰਕ ਅਤੇ ਦਿਮਾਗੀ ਵਿਕਾਸ ਕਰਦੀਆਂ ਹਨ ਖੇਡਾਂ ਖੇਡਣ ਦੇ ਨਾਲ ਬੱਚੇ ਦਾ ਸਰੀਰ ਵੀ ਫਿੱਟ ਰਹਿੰਦਾ ਹੈ ਅਤੇ ਉਸ ਦਾ ਦਿਮਾਗ ਵੀ ਵਿਕਸਿਤ ਹੂੰ ਵਿਕਸਿਤ ਹੁੰਦਾ ਹੈ ਜਿਸ ਨਾਲ ਕਿ ਉਹ ਇੱਕ ਚੰਗਾ ਸਮਾਜ ਵਿਕਸਿਤ ਕੀਤਾ ਜਾ ਸਕਦਾ ਹੈ ਖੇਡਾਂ ਅੱਜ ਕੱਲ੍ਹ ਇੰਟਰਨੈਸ਼ਨਲ ਖੇਡਾਂ ਪੱਧਰ 'ਤੇ ਪਹੁੰਚ ਗਈਆਂ ਹਨ ਕਈ ਅਜਿਹੀਆਂ ਖੇਡਾਂ ਹਨ ਜਿਹੜੀਆਂ ਪੇਂਡੂ ਖੇਡਾਂ ਹੁੰਦੇ ਹੋਏ ਵੀ ਇੰਟਰਨੈਸ਼ਨਲ ਪੱਧਰ 'ਤੇ ਪਹੁੰਚ ਗਈਆਂ ਹਨ ਅਤੇ ਇਸ ਤਰ੍ਹਾਂ ਖੇਡਾਂ ਦਾ ਇੱਕ ਸਮਾਜ ਵਿੱਚ ਬਹੁਤ ਬੜਾ ਮਹੱਤਵ ਹੈ